ਨਹੀਂ ਮੈਂ ਕਦੀ ਵੀ ਕਿਸੇ ਵਿਕਲਪਿਕ ਰਨਿੰਗ ਵਰਕਆਊਟ ਦੀ ਕੋਸ਼ਿਸ਼ ਨਹੀਂ ਕੀਤੀ ਹੈ ਜਿਵੇਂ ਕਿ ਟਰੇਲ ਰੇਨਿੰਗ ਅਤੇ ਸਪਰਿੰਟ ਅੰਤਰਾਲ ਦੌੜਨ ਲਈ ਮੈਂ ਆਪਣੇ ਕੋਲੇਜ ਗਰਾਊਂਡ ਵਿੱਚ ਸਵੇਰੇ ਜਾਂਦੀ ਹਾਂ ਜੋ ਕਿ ਮੈਨੂੰ ਤੰਦਰੁਸਤ ਰੱਖਣ ਲਈ ਮੇਰੀ ਮਦਦ ਕਰਦੇ ਹਨ ਅਤੇ ਮੈਂ ਰਨਿੰਗ ਕਰਨ ਤੋਂ ਬਾਅਦ ਬਹੁਤ ਹੀ ਫਰੈੱਸ ਫੀਲ ਕਰਦੀ ਹਾਂ